ਹੈਲੋ ਹਾਂਜੀ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਸਾਰੇ ਤਿਉਹਾਰ ਮਨਾਏ ਜਾਂਦੇ ਨੇ ਤੁਸੀਂ ਕਿਹੜੇ ਤਿਉਹਾਰ ਬਾਰੇ ਜਿਆਦਾ ਪੁੱਛਣਾ ਚਾਹੁੰਦੇ ਹੋ ਸਾਡੇ ਤੋਂ ਹਾਂਜੀ ਮਾਘੀ ਦਾ ਮੇਲਾ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਐ ਪੰਜਾਬ ਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਮਾਘੀ ਦਾ ਮੇਲਾ ਬੜਾ ਧੂਮਧਾਮ ਨਾਲ ਲੋਕੀ ਮਨਉਂਦੇ ਨੇ ਤੇ ਇਸ ਤੋਂ ਪਹਿਲਾਂ ਲੋਹੜੀ ਆਂਦੀ ਏ ਇੱਕ ਦਿਨ ਪਹਿਲਾਂ ਲੋਹੜੀ ਵੀ ਲੋਕੀ ਬੜੇ ਧੂਮਧਾਮ ਨਾਲ ਮਨਾਉਂਦੇ ਨੇ ਤੇ ਮਾਘੀ ਦੇ ਮੇਲੇ ਤੋਂ ਦੂਸਰੇ ਦਿਨ ਇੱਥੇ ਘੋੜ ਦੌੜ ਹੁੰਦੀ ਹੈ ਉਹ ਵੀ ਲੋਕੀ ਬੜਾ ਹੀ ਦੂਰੋਂ ਦੂਰੋਂ ਚੱਲ ਕੇ ਦੇਖਣ ਵਾਸਤੇ ਆਉਂਦੇ ਨੇ ਤੇ ਉਸ ਤੋਂ ਬਾਅਦ ਵਿੱਚ ਤੇ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਬਸੰਤ ਪੰਚਮੀ ਵੀ ਮਨਾਈ ਜਾਂਦੀ ਹੈ ਤੇ ਦਿਵਾਲੀ ਦੀ ਮਨਾਈ ਜਾਂਦੀ ਹੈ ਤੇ ਤੀਆਂ ਦਾ ਤਿਉਹਾਰ ਵੀ ਬੜਾ ਧੂਮ ਧਾਮ ਨਾਲ ਲੋਕੀ ਬਣਾਉਂਦੇ ਨੇ ਤੇ ਇਥੇ ਦੁਸ਼ਹਿਰਾ ਵੀ ਬੜੇ ਇਹ ਵੱਡੇ ਸਟੇਡੀਅਮ ਦੇ ਵਿੱਚ ਧੂਮਧਾਮ ਨਾਲ ਲੋਕੀ ਦੂਰੋਂ ਦੂਰੋਂ ਚੱਲ ਕੇ ਆ ਕੇ ਦੇਖਦੇ ਨੇ ਪਰ ਮਾਘੀ ਮੇਲਾ ਦਾ ਮੁਕਤਸਰ ਦੇ ਵਿੱਚ ਜ਼ਿਆਦਾ ਫੇਮਸ ਨੇ ਤੇ ਉਹਦਾ ਇਸ ਤੋਂ ਇੱਕ ਦਿਨ ਪਹਿਲਾਂ ਲੋਹੜੀ ਮਨਾਉਂਦੇ ਨੇ ਜਿਹੜੇ ਲੋਕੀ ਆਪਣੇ ਘਰਾਂ ਦੇ ਵਿੱਚ ਆਪਦੇ ਰਿਸ਼ਤੇਦਾਰਾਂ ਨੂੰ ਲੋਹੜੀ ਦੇਣ ਜਾਂਦੇ ਆ ਲੋਹੜੀ ਦੇ ਵਿੱਚ ਲੋਕੀ ਮੂੰਗਫਲੀ ਰਿਊੜੀ ਤੇ ਡਰਾਈ ਫੁਟ ਵੀ ਰੱਖਦੇ ਨੇ ਤੇ ਇਦਾਂ ਹੀ ਇਹ ਤਿਉਹਾਰ ਨੂੰ ਬੜੇ ਧੂਮਧਾਮ ਨਾਲ ਲੋਕੀਂ ਮਨਾਉਂਦੇ ਨੇ ਚਾਲੀ ਮੁਕਤੀਆਂ ਦੀ ਧਰਤੀ ਨੇ ਇੱਥੇ ਲੋਕੀ ਬੜੇ ਹੀ ਦੂਰੋਂ ਚਲ ਚਲ ਕੇ ਇਹਨਾਂ ਗੁਰਦੁਆਰਿਆਂ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਆਉਂਦੇ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਕਾਫੀ ਗੁਰਦੁਆਰੇ ਨੇ ਇਹਨਾਂ ਗੁਰਦੁਆਰਿਆਂ ਵਿੱਚ ਮੇਨ ਸਿੰਘ ਸਭਾ ਵੱਡਾ ਗੁਰਦੁਆਰਾ ਜੋ ਬਾਜ਼ਾਰ ਦੇ ਵਿੱਚ ਉਹ ਕਾਫੀ ਫੇਮਸ ਹੈ ਤੇ ਇਥੇ ਬੀਬੀ ਸਾਹਿਬ ਰਿਕਾਬ ਸਾਹਿਬ ਤੇ ਦਾਤਨ ਸਾਹਿਬ ਗੁਰਦੁਆਰਾ ਜਲਾਲਾਬਾਦ ਰੋਡ ਤੇ ਨੇ ਉਹ ਗੁਰਦੁਆਰਿਆਂ ਦਾ ਵੀ ਬਹੁਤ ਇਤਿਹਾਸ ਨੇ ਇੱਥੇ ਬਾਬਾ ਜੀ ਨੇ ਦਾਤਾਨ ਦਾਤਨ ਸਾਹਿਬ ਗੁਰਦੁਆਰੇ ਆ ਕੇ ਦਾਤਨ ਕੀਤੀ ਸੀ ਤੇ ਉਸ ਦੇ ਪ੍ਹਤੀ ਵੀ ਬਹੁਤ ਵੱਡਾ ਇਤਿਹਾਸ ਨੇ ਇਹ ਜਿਹੜਾ ਵੀ ਯਾਤਰੀ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਦਾਤਾਨ ਸਾਹਿਬ ਗੁਰਦੁਆਰੇ ਮੱਥਾ ਟੇਕ ਕੇ ਤੇ ਉਹਦੀ ਕੋਲੇ ਇੱਕ ਮੁਸਲਮਾਨ ਦੀ ਖਬਰ ਬਣੀ ਹੋਈ ਹੈ ਉੱਥੇ ਜਿਹਨਾਂ ਚਿਕਰ ਉਸ ਖਬਰ ਤੇ ਛਿੱਤਰ ਨਹੀਂ ਮਾਰਦਾ ਉਸਦੀ ਉਹਨਾਂ ਚਿਕਰ ਯਾਤਰਾ ਸਫਲ ਨਹੀਂ ਹੁੰਦੀ ਇਹੀ ਮਾਘੀ ਦੇ ਮੇਲੇ ਵਾਲੀ ਦਿਨ ਇੱਥੇ ਜਿੰਨੇ ਵੀ ਲੋਕੀ ਮੱਥਾ ਟੇਕਣ ਵਾਸਤੇ ਆਉਂਦੇ ਆ ਉਹ ਦੂਰੋਂ ਦੂਰੋਂ ਚੱਲ ਕੇ ਤੇ ਇਸ ਕਬਰ ਤੇ ਛਿੱਤਰ ਮਾਰ ਕੇ ਜਾਂਦੇ ਨੇ ਇਹਦੇ ਨਾਲ ਉਹ ਆਪਦੀ ਯਾਤਰਾ ਨੂੰ ਸਫਲ ਕਰਦੇ ਨੇ ਤੇ ਦੂਸਰੇ ਦਿਨ ਇੱਥੇ ਘੋੜ ਦੌੜ ਹੁੰਦੀ ਐ ਜੋ ਕਿ ਬੜੀ ਹੀ ਧੂਮਧਾਮ ਨਾਲ ਮਨਾਈ ਜਾਂਦੀ ਨੇ ਇਹ ਲੋਕੀ ਦੂਰੋਂ ਦੂਰੋਂ ਚੱਲ ਕੇ ਟਰੈਕਟਰਾਂ ਤੇ ਟਰਾਲੀਆਂ ਤੇ ਤੇ ਆਪਦੇ ਇਹ ਵੱਡੇ ਵੱਡੇ ਸਾਧਨਾਂ ਤੇ ਇਥੇ ਆਉਂਦੇ ਨੇ ਤੇ ਇਸ ਘੋੜ ਦੌੜ ਨੂੰ ਦੇਖਦੇ ਨੇ ਤੇ ਇਹ ਇਸ ਮੁਕਤਸਰ ਸ਼ਹਿਰ ਦੇ ਵਿੱਚ ਸਾਰੇ ਹੀ ਤਿਉਹਾਰ ਬੜੇ ਧੂਮਧਾਮ ਨਾਲ ਮਨਾਏ ਜਾਂਦੇ ਨੇ ਠੀਕ ਹੈ ਠੀਕ ਹੈ ਜੀ